ਇਸ ਦੀ ਡਿਸਪਲੇ ਵੀ ਬਹੁਤ ਵਧੀਆ ਹੈ ਬਹੁਤ ਹੀ ਜ਼ਿਆਦਾ ਐਚ ਡੀ ਡਿਸਪਲੇ ਹੈ ਕੀਬੋਰਡ ਅਤੇ ਮਾਊਸ ਵੀ ਬਹੁਤ ਚੰਗੀ ਤਰ੍ਹਾਂ ਸਮੂਦਲੀ ਕੰਮ ਕਰਦੇ ਹਨ ਇਹ ਲੈਪਟੋਪ ਹੈ ਜੋ ਮੈਂ ਇਸਦੇ ਕੋਲੇਜ ਅਤੇ ਦਫਤਰ ਦੋਨਾਂ ਦਾ ਕੰਮ ਕਰਦੀ ਹਾਂ ਘੱਟੋ ਘੱਟ ਮੈਂ ਇਸ 'ਤੇ ਅਠਾਰਾਂ ਵੀਹ ਘੰਟੇ ਕੰਮ ਕਰਦੀ ਹਾਂ ਅਤੇ ਇਹ ਬਿਲਕੁਲ ਵੀ ਗਰਮ ਨਹੀਂ ਹੁੰਦਾ ਇਸ ਦਾ ਵੇਟ ਹੈ ਜੋ ਉਹ ਵੀ ਬਹੁਤ ਹੀ ਹਲਕਾ ਹੈ ਮੈਂ ਇਸਨੂੰ ਆਸਾਨੀ ਨਾਲ ਕਿਤੇ ਵੀ ਲੈ ਕੇ ਜਾ ਸਕਦੀ ਹਾਂ ਜਦੋਂ ਇਹ ਲੈਪਟੋਪ ਮੇਰੇ ਕੋਲ ਆਇਆ ਸੀ ਇਸ ਦੀ ਪੈਕਿੰਗ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਅਤੇ ਸੇਫ ਤਰੀਕੇ ਨਾਲ ਕੀਤੀ ਹੋਈ ਸੀ ਅਤੇ ਜੋ ਤੁਸੀਂ ਮੈਨੂੰ ਇਸ 'ਤੇ ਵੀਹ ਪਰਸੈਂਟ ਡਿਸਕਾਊਂਟ ਦਿੱਤਾ ਹੈ ਉਸ ਤੋਂ ਸਾਰੇ ਹੀ ਬਹੁਤ ਜ਼ਿਆਦਾ ਹੈਰਾਨ ਹਨ ਕਿ ਇੰਨੀ ਘੱਟ ਕੀਮਤ ਉੱਤੇ ਇੰਨੀ ਵਧੀਆ ਚੀਜ਼ ਮਿਲ ਗਈ ਅਤੇ ਮੈਂ ਆਪਣੇ ਅੱਗੇ ਦੋਸਤਾਂ ਨੂੰ ਵੀ ਇਹੀ ਸਲਾਹ ਦੇਵਾਂਗੀ ਕਿ ਉਹ ਤੁਹਾਡੇ ਪੇਜ ਤੋਂ ਹੀ ਸ਼ੋਪਿੰਗ ਕਰਨ ਧੰਨਵਾਦ